ਹਾਂਜੀ ਜੇ ਮੈਂ ਆਪਣੇ ਖੇਤਰ ਦੇ ਕੁਝ ਰੁਜ਼ਗਾਰ ਖੇਤਰਾਂ ਦੀ ਗੱਲ ਕ ਮੈਂ ਜੇਕਰ ਮੈਂ ਆਪਣੇ ਖੇਤਰ ਦੇ ਕੁਝ ਰੁਜ਼ਗਾਰ ਖੇਤਰਾਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸਾਡੇ ਇੱਥੇ ਰੁਜ਼ਗਾਰ ਦਾ ਜਿਹੜਾ ਮੇਨ ਸਾਧਨ ਬਣਿਆ ਉਹ ਸਰਕਾਰੀ ਨੌਕਰੀ ਬਣਿਆ ਹੋਇਆ ਹੈ ਜਾਂ ਕਈ ਲੋਕ ਆਪਣਾ ਬਿਜਨਸ ਕਰਨ ਦੇ ਵੀ ਬਹੁਤ ਚਾਹਵਾਨ ਹਨ ਬਟ ਜਿਹੜੇ ਸਾਡੇ ਇੱਧਰ ਖੇਤਰ ਦੇ ਵਿੱਚ ਸਭ ਤੋਂ ਜ਼ਿਆਦਾ ਚਾਹਵਾਨ ਲੋਕ ਹਨ ਉਹ ਨੇ ਸਰਕਾਰੀ ਨੌਕਰੀ ਉਹਦੇ ਵਿੱਚ ਜੇਕਰ ਸਰਕਾਰੀ ਨੌਕਰੀ ਦੇ ਵਿੱਚ ਜੇਕਰ ਆਪਾਂ ਮੁੱਖ ਗੱਲ ਕਰੀਏ ਤਾਂ ਟੀਚਰ ਲਾਈਨ ਜੋ ਹੈ ਜਿਹੜਾ ਅਧਿਆਪਕ ਹੈ ਉਹ ਸਭ ਤੋਂ ਜ਼ਿਆਦਾ ਸਾਡੇ ਇੱਥੇ ਏਰੀਏ ਦੇ ਵਿੱਚ ਲੋਕ ਉਹਦੇ ਲਈ ਪ੍ਰੇਰਿਤ ਹਨ ਜਾਂ ਉਹ ਲੱਗੇ ਹੋਏ ਹਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਕ ਮਹੱਲੇ ਦੇ ਵਿੱਚ ਇੱਕ ਮੁਹੱਲੇ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਜੇ ਉੱਥੇ ਦਸ ਘਰ ਹਨ ਅਤੇ ਦਸ ਦੇ ਵਿੱਚੋਂ ਛੇ ਘਰ ਸਰਕਾਰੀ ਨੌਕਰੀ ਤੋਂ ਆਪਣਾ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ ਜਾਂ ਸ ਜਿਹੜੇ ਆਉਣ ਵਾਲੇ ਬੱਚੇ ਵੀ ਹੈ ਉਹ ਵੀ ਸਰਕਾਰੀ ਨੌਕਰੀਆਂ ਅਤੇ ਅ ਉਹ ਵੀ ਸਰਕਾਰੀ ਨੌਕਰੀਆਂ ਦੀ ਤਿਆਰੀਆਂ ਕਰ ਰਹੇ ਨੇ ਜਾਂ ਸਰਕਾਰੀ ਨੌਕਰੀਆਂ ਕਰਨ ਦੇ ਚਾਹਵਾਨ ਹਨ ਬਟ ਜਿਵੇਂ ਕਿ ਅੱਜ ਦੇ ਯੁੱਗ ਦੇ ਵਿੱਚ ਜੇਕਰ ਸਰਕਾਰਾਂ ਦੀ ਗੱਲ ਕੀਤੀ ਜਾਵੇ ਸਰਕਾਰਾਂ ਸਟਾਰਟਅਪ ਜਿਹੜੇ ਨਵੇਂ ਸਟਾਰਟਅਪ ਹੈ ਜਾਂ ਨਵੇਂ ਕੋਈ ਬਿਜਨਸ ਨੂੰ ਲੈ ਕੇ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ ਉੱਥੇ ਹੀ ਸਾਡੇ ਖੇਤਰ ਦੇ ਵਿੱਚ ਸਟਾਰਟਅਪ ਜਿਹੜਾ ਹੈ ਉਹ ਥੋੜ੍ਹਾ ਘੱਟ ਹੈ ਕਿਉਂਕਿ ਲੋਕ ਜਿਹੜੇ ਹੈ ਉਹ ਥੋੜ੍ਹਾ ਜਿਹਾ ਲੋਕਾਂ ਦਾ ਜ਼ਿਆਦਾ ਰੁਝਾਨ ਸਰਕਾਰੀ ਨੌਕਰੀਆਂ ਵੱਲ ਹੈ ਜਾਂ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਜਿਹੜੇ ਨੌਕਰੀ ਅ ਕਰਨ ਦੇ ਚਾਹਵਾਨ ਹਨ ਸ਼ਹਿਰੀ ਖੇਤਰ ਹੋਣ ਕਰਕੇ ਜਿਹੜਾ ਖੇਤੀਬਾੜੀ ਵਾਲਾ ਕੰਮ ਹੈ ਜਾਂ ਉਹ ਵੀ ਘੱਟ ਹੈ ਬਟ ਜਿੰਨਾ ਕਈ ਲੋਕ ਪੈਸਟੀਸਾਈਡ ਦੀਆਂ ਦੁਕਾਨਾਂ 'ਤੇ ਵੀ ਕੰਮ ਕਰਦੇ ਹਨ ਅਤੇ ਇੱਕ ਸਾਡੇ ਇੱਥੇ ਜਿਹੜਾ ਮੈਡੀਕਲ ਲਾਈਨ ਜਿਵੇਂ ਕਿ ਮੈਡੀਕਲ ਰੀਪ੍ਰਜੈਂਟੇਟਿਵ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਉਹ ਰੁਜ਼ਗਾਰ ਵੀ ਬਹੁਤ ਮਸ਼ਹੂਰ ਹੈ ਲੋਕ ਉਹਨਾਂ ਵਿੱਚ ਵੀ ਜਾਣ ਦੇ ਬਹੁਤ ਇੱਛੁਕ ਹਨ ਜਿਵੇਂ ਕਿ ਦਵਾਈਆਂ ਦੀ ਸੇਲ ਪਰਚੇਜ ਜਾਂ ਖਰੀਦ ਕਰਨੀ ਜਾਂ ਉਹਨਾਂ ਨੂੰ ਕੰਪਨੀਆਂ ਦੇ ਥਰੂ ਲੋਕਾਂ ਡਾਕਟਰਾਂ ਤੱਕ ਪਹੁੰਚਾਉਣਾ ਉਹ ਇੱਕ ਵਧੀਆ ਕਾਰੋਬਾਰ ਮੰਨਿਆ ਜਾਂਦਾ ਹੈ ਬਟ ਜਿਹੜਾ ਮੇਨ ਕਾਰੋਬਾਰ ਹੈ ਉਹ ਹੈ ਸਰਕਾਰੀ ਨੌਕਰੀ ਤਿਆਰੀ ਕਰਨਾ ਇੱਕ ਸਰਕਾਰੀ ਅਫਸਰ ਦੇ ਅਸ ਅ ਦਫਤਰ ਦੇ ਅਫਸਰ ਬਣ ਕੇ ਉਹ ਕੁਰਸੀ 'ਤੇ ਬੈਠਣਾ ਅਤੇ ਲੋਕਾਂ ਲੋਕਾਂ ਲਈ ਸੇਵਾਵਾਂ ਪ੍ਰਦਾਨ ਕਰਨੀਆਂ ਇਹਨਾਂ ਨੂੰ ਆਪਾਂ ਲੋਕ ਸੇਵਾਵਾਂ ਦੇ ਵਿੱਚ ਹੀ ਗਿਣ ਸਕਦੇ ਹਾਂ ਅਤੇ ਇਹ ਸਾਡੇ ਇੱਥੇ ਜਿਹੜੇ ਖੇਤਰ ਹੈ ਉਹਦੀਆਂ ਮੁੱਖ ਸੇਵਾਵਾਂ ਹਨ ਅਤੇ ਇਹਨਾਂ 'ਚ ਲੋਕਾਂ ਨੂੰ ਬਹੁਤ ਚੁਣੌਤੀਆਂ ਵੀ ਆਉਂਦੀਆਂ ਹਨ ਬਟ ਲੋਕ ਚੁਣੌਤੀਆਂ ਤੋਂ ਨਿਜਾਤ ਪਾ ਕੇ ਪਾਲ ਨੂੰ ਨੌਕਰੀਆਂ ਪਾ ਰਹੇ ਹਨ